ਬਾਈ ਜੂਨ ਦੋ ਹਜ਼ਾਰ ਤਿੰਨ ਸਤਾਈ ਮਾਰਚ ਦੋ ਹਜ਼ਾਰ ਛੇ ਪੰਦਰਾਂ ਜੁਲਾਈ ਦੋ ਹਜ਼ਾਰ ਤਿੰਨ ਪੰਦਰਾਂ ਦਸੰਬਰ ਉੱਨੀ ਸੌ ਚੁਹੱਤਰ ਉਨੱਤੀ ਸਤੰਬਰ ਦੋ ਹਜ਼ਾਰ ਤਿੰਨ